ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਮੇਰੇ ਫ੍ਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਇਹ ਵੀ ਸਮਾਨ ਦੇਖਣਾ ਸੀ ਕੋਈ ਹਾਂਜੀ ਤਾਂ ਇ ਇਹ ਕਿਆ ਕਿਆ ਤੁਹਾਡੇ ਕੋਲ ਅੱਛਾ ਜੀ ਅਤੇ ਇਹ ਜੈਨਟਸ ਦੇ ਕੀ ਕੀ ਹੈ ਤੁਹਾਡੇ ਅੱਛਾ ਜੀ ਪੱਗਾਂ ਸਾਰੇ ਰੰਗਾਂ ਦੀ ਹੁੰਦੀਆਂ ਅੱਛਾ ਅੱਠ ਮੀਟਰ ਦੀ ਲੈਣੀ ਸੀ ਕਿੰਨਾ ਪੰਜ ਸੌ ਅੱਛਾ ਅਤੇ ਲੇਡੀਜ਼ ਦੇ ਇਹ ਕੀ ਕੀ ਦੱਸਿਆ ਸੀ ਤੁਸੀਂ ਹਾਂਜੀ ਇਹ ਜੁੱਤੀ ਜੁੱਤੀ ਲੈਣੀ ਸੀਗੀ ਇਹ ਕਿੰਨੇ ਕਿੰਨੇ ਨੰਬਰ ਦੀ ਇਹ ਸੱਤ ਨੰਬਰ ਦੀ ਮਿਲ ਜਾਵੇਗੀ ਪੰਜਾਬੀ ਜੁੱਤੀ ਜੀ ਲੇਡੀਜ਼ ਲਈ ਅੱਛਾ ਜੀ ਅਤੇ ਇੱਕ ਜੈਨਟਸ ਲਈ ਕੁੜਤਾ ਪਜਾਮਾ ਵੀ ਲੈਣਾ ਸੀ ਅੱਛਾ ਜੀ ਤੇ ਪਰਾਇਜ਼ ਦੱਸ ਸਕਦੇ ਆ ਜਿੰਨਾਂ ਕਿੰਨਾ ਕਿੰਨਾ ਕਰਦੇ ਓਂ ਤੁਸੀਂ ਜੋ ਪੰਜਾਬੀ ਜੁੱਤੀ ਦਾ ਕੀ ਪਰਾਇਜ਼ ਆ ਹਜ਼ਾਰ ਤੋਂ ਸਟਾਰਟਿੰਗ ਅੱਛਾ ਜੀ ਅਤੇ ਇਹ ਜੈਨਟਸ ਵਾਲੀ ਜੁੱਤੀ ਪੰਜਾਬੀ ਉਹਦੀ ਉਹਦਾ ਕੀ ਆ ਪਰਾਇਜ਼ ਹਾਂਜੀ ਅੱਛਾ ਜੀ ਅਤੇ ਕੈਂਠਾ ਵੀ ਹੈਗਾ ਤੁਹਾਡੇ ਕੋਲ ਅੱਛਾ ਜੀ ਇਹ ਅਲੱਗ ਅਲੱਗ ਸਟਾਈਲ ਵਾਲਾ ਓਕੇ ਜੀ ਅਤੇ ਠੀਕ ਹੈ ਜੀ ਇਹ ਤੁਸੀਂ ਆਪਣਾ ਮੈਨੂੰ ਐਡਰੈੱਸ ਸੈਂਡ ਕਰ ਦਿਓ ਮੈਂ ਆਊਂਗਾ ਜੀ ਤੁਹਾਡੇ ਕੋਲ